ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ

ਹਿਮਾਚਲ ਵਿੱਚ ਮਕਲੋਡਗੰਜ ਘੁੰਮਣ ਗਿਆ ਹੋਇਆ ਸੀ ਤਾਂ ਮੈਂ ਉੱਥੇ ਸੈਲਾਨੀਆਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਉਹਨਾਂ ਦੀ ਖ਼ੇਤਰ ਜਿਵੇਂ ਕਨੇਡਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਦੋਂ ਉਹਨਾਂ ਨੇ ਮੈਨੂੰ ਉੱਥੋਂ ਦੇ ਬਾਰੇ ਦੱਸਿਆ ਤਾਂ ਮੈਨੂੰ ਪਤਾ ਲੱਗਾ ਵੀ ਉਹ ਲੋਕ ਕਿੰਨੇ ਨਿਡਰ ਅਤੇ ਬਹਾਦੁਰ ਹਨ ਜੋ ਛੋਟੇ ਛੋਟੇ ਆਪਣੇ ਬੱਚਿਆਂ ਨੂੰ ਇੰਨੀ ਦੂਰ ਘੁੰਮਣ ਨੂੰ ਭੇਜ ਦਿੰਦੇ ਹਨ

ਮੈਨੂੰ ਇਸ ਤੋਂ ਸਿੱਖਿਆ ਪ੍ਰਾਪਤ ਮਿਲੀ ਮਿਲੀ ਕਿ ਸਾਨੂੰ ਵੀ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਹਾਦਰ ਅਤੇ ਨਿਡਰ ਬਣਾਉਣਾ ਚਾਹੀਦਾ ਹੈ ਉਹਨਾਂ ਨੂੰ ਖੂਹ ਦੇ ਡੱਡੂ ਦੀ ਤਰ੍ਹਾਂ ਨਹੀਂ ਰੱਖਣਾ ਚਾਹੀਦਾ

ਜਦੋਂ ਉਹਨਾਂ ਨੇ ਮੈਨੂੰ ਆਪਣੇ ਸਥਾਨਾਂ ਬਾਰੇ ਦੱਸਿਆ ਤਾਂ ਉਹਨਾਂ ਦੇ ਸਥਾਨ ਵੀ ਇੱਕ ਕੁਦਰਤੀ ਨਜ਼ਾਰਿਆਂ ਨਾਲ ਭਰੇ ਹੋਏ ਸਨ ਫਿਰ ਵੀ ਉਹ ਸਾਡੇ ਭਾਰਤ ਵਿੱਚ ਘੁੰਮਣ ਆਉਂਦੇ ਹਨ ਉਹ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਸਾਡੀ ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕਰਦੇ ਹਨ ਧੰਨਵਾਦ